ਸਾਡੇ ਇਲਾਕੇ ਦੇ ਵਿੱਚ ਪ੍ਰਸਿੱਧ ਸਕੂਲ ਨੇ ਜੀ ਸੈਟ ਫਰਾਂਸਿਸ ਇੰਟਰਨੈਸ਼ਨਲ ਸਕੂਲ ਹੈ ਜਿਹੜਾ ਦਸ਼ਮੇਸ਼ ਪਰਿਵਾਰ ਪਬਲਿਕ ਸਕੂਲ ਅਤੇ ਹਰਕ੍ਰਿਸ਼ਨ ਪਬਲਿਕ ਸਕੂਲ ਹਾਵਰਡ ਲੇਨ ਸਕੂਲ ਅਤੇ ਬਹੁਤ ਮਸ਼ਹੂਰ ਸਕੂਲ ਨੇ ਵੱਡੇ ਸਕੂਲ ਨੇ ਬਹੁਤ ਵਧੀਆ ਖੁੱਲ੍ਹੇ ਇੱਥੇ ਸੀ ਬੀ ਐਸ ਈ ਪੈਟਰਨ ਵੀ ਆ ਅਤੇ ਪੀ ਪੰਜਾਬ ਸਕੂਲ ਐਜੂਕੇਸ਼ਨ ਵੀ ਆ ਅਤੇ ਪੜ੍ਹਾਈ ਇੱਥੇ ਵਧੀਆ ਟੀਚਰ ਰੱਖੇ ਹੋਏ ਨੇ ਵੈਲ ਕੁਆਲੀਫਾਈ ਟੀਚਰ ਨੇ ਸਕੂਲ ਦੀ ਸਫਾਈ ਅਤੇ ਸਕੂਲਾਂ ਦੀ ਗੇਮਾਂ ਦਾ ਵੀ ਪ੍ਰਬੰਧ ਆ ਬੱਚਿਆਂ ਨੂੰ ਪੜ੍ਹਾਉਣ ਦਾ ਵਧੀਆ ਤਰੀਕਾ ਅਤੇ ਸ਼ਹਿਰਾਂ ਦੇ ਵਿੱਚ ਵੀ ਸਕੂਲ ਵਧੀਆ ਨੇ ਬਟ ਉੱਥੇ ਸ਼ਹਿਰਾਂ ਦੇ ਵਿੱਚ ਸਾਨੂੰ ਹੁਣ ਪ੍ਰੋਬਲਮ ਆਉਂਦੀ ਹੈ ਜਾਣ ਵਾਸਤੇ ਜਿਵੇਂ ਕਿ ਸਾਨੂੰ ਉੱਥੋਂ ਦੀ ਟਰਾਂਸਪੋਰਟ ਦੀ ਪ੍ਰੋਬਲਮ ਆਉਂਦੀ ਹੈ ਜ਼ਿਆਦਾਤਰ ਇੱਕ ਟਰੈਫਿਕ ਬਹੁਤ ਜ਼ਿਆਦਾ ਹੋਣ ਕਰਕੇ ਇਹ ਸਾਨੂੰ ਲੋਕਲ ਪੈਂਦੇ ਆ ਅਤੇ ਇਸ ਕਰਕੇ ਅਸੀਂ ਆਪਣੇ ਪਿੰਡਾਂ ਦੇ ਸਕੂਲ ਜਿਹੜੇ ਸਾਨੂੰ ਉਹ ਇਹੀ ਕਸਬਿਆਂ ਦੇ ਵਿੱਚ ਸਕੂਲ ਜਿਹੜੇ ਵਧੀਆ ਅਤੇ ਵਧੀਆ ਸਿੱਖਿਆ ਹੋਣ ਕਰਕੇ ਇੱਥੋਂ ਦੇ ਯਾਨੀ ਕਿ ਵਧੀਆ ਲੱਗਦੇ ਸਾਨੂੰ ਇੱਥੋਂ ਦੀ ਪੜ੍ਹਾਈ ਵੀ ਵਧੀਆ ਹੋਣ ਕਰਕੇ ਇੱਥੋਂ ਦੇ ਬੱਚਿਆਂ ਦੇ ਗੇਮਾਂ ਨੂੰ ਵੀ ਪ੍ਰਬੰਧ ਕਰਦੇ ਆ ਨਾਲੇ ਸਾਨੂੰ ਇਹ ਜ਼ਿਆਦਾ ਟ੍ਰੈਫਿਕ 'ਚ ਨਹੀਂ ਪੈਂਦੇ ਇਹਨਾਂ ਦੀ ਟ੍ਰਾਂਸਪੋਰਟ ਸਾਨੂੰ ਈਜ਼ੀ ਹੋ ਜਾਂਦੀ ਆ ਸੌਖਾ ਹੋ ਜਾਂਦਾ ਸਾਨੂੰ ਇਸ ਕਰਕੇ